ਯੋਗ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਮੈਂ ਰੋਜ਼ ਉਸ ਸਵੇਰਾ ਉੱਠ ਕੇ ਯੋਗ ਕਰਦੀ ਹਾਂ ਯੋਗ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਯੋਗ ਕਰਨ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਯੋਗ ਸਾਨੂੰ ਬੀ ਪੀ ਵਧਣ ਨਾ ਵਿੱਚ ਮਦਦ ਕਰਦਾ ਹੈ ਯੋਗ ਨਾਲ ਸਾਨੂੰ ਬਹੁਤ ਸਾਰੀਆਂ ਸਮੱਸਿਆ ਦੂਰ ਹੁੰਦੀਆਂ ਹਨ ਨਾਲੇ ਟਾਈਮ ਪਾਸ ਹੁੰਦਾ ਹੈ ਮੈਂ ਪਾਰਕ ਵਿੱਚ ਜਾ ਕੇ ਆਪਣੀਆਂ ਸਹੇਲੀਆਂ ਨਾਲ ਵੀ ਯੋਗਾ ਕਰਦੀ ਹਾਂ ਮੈਨੂੰ ਯੋਗਾ ਕਰਨਾ ਬਹੁਤ ਪਸੰਦ ਹੈ ਮੈਂ ਯੋਗਾ ਕਰਨ ਵਿੱਚ ਪੂਰਾ ਧਿਆਨ ਦਿੰਦੀ ਹਾਂ ਇਸ ਲਈ ਵੀ ਮੇਰਾ ਸਰੀਰ ਤੰਦਰੁਸਤ ਰਹਿੰਦਾ ਹੈ ਸਾਨੂੰ ਯੋਗਾ ਹਰ ਰੋਜ਼ ਕਰਨਾ ਚਾਹੀਦਾ ਹੈ ਇਸ ਲਈ ਮੈਂ ਸਭ ਨੂੰ ਇਹ ਹੀ ਸਲਾਹ ਦਿੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਯੋਗ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਵੀ ਯੋਗਾ ਸਿਖਾਉਣਾ ਚਾਹੀਦਾ ਹੈ ਬਜ਼ੁਰਗਾਂ ਨੂੰ ਤਾਂ ਬਹੁਤ ਜ਼ਿਆਦਾ ਵਧੀਆ ਹੈ ਸਾਨੂੰ ਯੋਗਾ ਬਹੁਤ ਜ਼ਰੂਰੀ ਹੈ ਇਸ ਲਈ ਸਾਨੂੰ ਯੋਗ ਕਰਨਾ ਬਹੁਤ ਜ਼ਿਆਦਾ ਵਧੀਆ ਇਸ ਲਈ ਮੈਨੂੰ ਯੋਗਾ ਕਰਨਾ ਬਹੁਤ ਵਧੀਆ ਲੱਗਦਾ ਹੈ ਸਾਨੂੰ ਹਰ ਸਮੇਂ ਭੁੱਲਣਾ ਨਹੀਂ ਚਾਹੀਦਾ ਕਿ ਸੁਬਹਾ ਉੱਠ ਕੇ ਅਸੀਂ ਯੋਗਾ ਕਰਨਾ ਹੀ ਕਰਨਾ ਹੈ ਯੋਗਾ ਮਾਸਪੇਸ਼ੀਆਂ ਦੇ ਸੁਧਾਰ ਲਈ ਬਹੁਤ ਅੱਛਾ ਹੈ ਇਸ ਨਾਲ ਸਾਡਾ ਪਾਚਣ ਤੰਤਰ ਚੰਗਾ ਬਣਦਾ ਹੈ ਅੰਦਰੂਨੀ ਅੰਗਾਂ ਨੂੰ ਮਜ਼ਬੂਤੀ ਮਿਲਦੀ ਹੈ ਦਮੇ 'ਤੇ ਇਲਾਜ ਕਰਦਾ ਹੈ ਅਤੇ ਇਹ ਸ਼ੂਗਰ ਵਿੱਚ ਵੀ ਰੁਕਾਵਟ ਪਾਉਂਦਾ ਹੈ ਸ਼ੂਗਰ ਨੂੰ ਮੁਕਤ ਬਿਲਕੁਲ ਮੁਕਤ ਕਰ ਦਿੰਦਾ ਹੈ ਦਿਲ ਦੀ ਸੰਬੰਧ ਸਮੱਸਿਆ ਨੂੰ ਵੀ ਇਲਾਜ ਵਿੱਚ ਮਦਦ ਕਰਦਾ ਹੈ ਅਤੇ ਚਿਹਰੇ 'ਤੇ ਨਖਾਰ ਲਿਆਉਂਦਾ ਹੈ ਸਾਨੂੰ ਆਸਣ ਕਰਨ ਪਦਸ ਸਾਸਨ ਬਹੁਤ ਜ਼ਰੂਰੀ ਹੈ ਪਦਮ ਆਸਣ ਕਰਨਾ ਚਾਹੀਦਾ ਹੈ ਸੀਸ ਆਸਣ ਭੁਚੰਗ ਆਸਣ ਧਨੁੱਸ਼ ਆਸਣ ਕਰਨਾ ਚਾਹੀਦਾ ਹੈ